ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਸਿਖਾਉਣ ਦੇ ਬਹੁਤ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਸਾਰੇ ਜਿਹੜੇ ਆ ਟੀਚਰਸ ਹਨ ਉਹ ਉਹਨਾਂ ਦੇ ਅੰਦਰ ਛਿਪੇ ਹੋਏ ਜਿਹੜੇ ਕਲਾਕਾਰ ਹਨ ਉਹਨਾਂ ਨੂੰ ਬਾਹਰ ਕੱਢਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ ਇਸ ਦੇ ਵਿੱਚ ਉਹ ਜਿਵੇਂ ਕਿ ਆਪਣੇ ਅਸੀਂ ਬਚਪਨ ਦੇ ਵਿੱਚ ਕਾਗਜ਼ ਤੋਂ ਪਰਸ ਬਣਾਉਣਾ ਕਾਗਜ਼ ਤੋਂ ਕਿਸ਼ਤੀਆਂ ਬਣਾਉਣੀਆਂ ਕਾਗਜ਼ ਤੋਂ ਬੰਦੂਕ ਤਿਆਰ ਕਰਨੀ ਆਦਿ ਅਸੀਂ ਜਿਹੜੀ ਇਹ ਤਿਆਰ ਕਰਦੇ ਹੁੰਦੇ ਸੀਗੇ ਅਤੇ ਅਸੀਂ ਆਪ ਵੀ ਬਣਾਉਂਦੇ ਹੁੰਦੇ ਸੀ ਅਤੇ ਆਪਣੇ ਨਾਲ ਦੇ ਦੋਸਤਾਂ ਨੂੰ ਸਹੇਲੀਆਂ ਨੂੰ ਵੀ ਅਸੀਂ ਇਹ ਸਿਖਾਉਂਦੇ ਹੁੰਦੇ ਸਨ ਸੋ ਅੱਜ ਵੀ ਜਿਹੜੇ ਹਨ ਵਿਦਿਆਰਥੀ ਹਨ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ